ਕੱਲ੍ਹ ਮੈਂ ਜਿਹੜੀ ਸਬਜ਼ੀ ਬਣਾ ਰਿਹਾ ਸੀ ਉਸ ਸਬਜ਼ੀ ਵਿੱਚ ਮੈਂ ਆਪਣੇ ਮਨਪਸੰਦ ਦੇ ਟੇਸਟ ਦੇ ਮੁਤਾਬਕ ਨਮਕ ਮਿਰਚ ਮਸਾਲਾ ਪਾਇਆ ਸੀ ਜਿਹਦੇ ਵਿੱਚ ਇਹ ਲੱਗਾ ਕਿ ਇਹ ਟੇਸਟ ਜਿਹੜਾ ਮੇਰੇ ਘਰਦਿਆਂ ਨੂੰ ਪਸੰਦ ਨਹੀਂ ਆਇਆ ਮੈਂ ਉਸ ਦੇ ਵਿੱਚ ਨਮਕ ਜ਼ਿਆਦਾ ਡਲ ਗਿਆ ਸੀ ਔਰ ਉਸ ਚੀਜ਼ ਨੂੰ ਮੈਂ ਵਿਚਾਰ ਕੀਤਾ ਕਿ ਇਹ ਅਸੀਂ ਬਣ ਸਬਜ਼ੀ ਬਣਾਉਣ ਵੇਲੇ ਨਮਕ ਘੱਟ ਤੋਂ ਘੱਟ ਪਾਈਏ ਤਾਂ ਕਿ ਜਿਸ ਵੇਲੇ ਉਹ ਖਾਣ ਵਾਲਾ ਬੰਦਾ ਆਪਣੇ ਟੇਸਟ ਦੇ ਮੁਤਾਬਕ ਵਿੱਚ ਐਡ ਵੀ ਕਰ ਸਕੇ ਕਿਉਂਕਿ ਜਿਹੜਾ ਨਮਕ ਪੈ ਗਿਆ ਉਹ ਕੱਢਿਆ ਨਹੀਂ ਜਾ ਸਕਦਾ ਇਸ ਕਰਕੇ ਇਸ ਚੀਜ਼ ਦੀ ਸਾਵਧਾਨੀ ਰੱਖ ਕੇ ਹੀ ਜਿਹੜਾ ਪ੍ਰੋਡਕਟ ਨੂੰ ਤਿਆਰ ਕਰਨਾ ਚਾਹੀਦਾ ਹੈ